ਪੰਜਾਬ ਵਿੱਚ ਕਈ ਤਰ੍ਹਾਂ ਦੇ ਲੋਕ ਰਹਿੰਦੇ ਹਨ ਜਿਵੇਂ ਹਿੰਦੂ ਸਿੱਖ ਇਸਾਈ ਅਤੇ ਇਸਲਾਮਿਕ ਅਤੇ ਇਸਲਾਮ ਨੂੰ ਮੰਨਣ ਵਾਲੇ ਵੀ ਰਹਿੰਦੇ ਹਨ ਅਤੇ ਜਿਹੜੇ ਹਿੰਦੂ ਹੈ ਉਹ ਆਪਣਾ ਮੰਦਰ ਵਿੱਚ ਜਾ ਕੇ ਪੂਜਾ ਕਰਦੇ ਹਨ ਜਿਹੜੇ ਇਸਾਈ ਹੈ ਉਹ ਆਪਣਾ ਚਰਚ ਦੇ ਵਿੱਚ ਜਾ ਕੇ ਕਰਦੇ ਹਨ ਅਤੇ ਜਿਹੜੇ ਸਿੱਖ ਹੈ ਉਹ ਆਪਣਾ ਗੁਰਦੁਆਰੇ ਵਿੱਚ ਜਾ ਕੇ ਸਵੇਰ ਅਤੇ ਸ਼ਾਮ ਪੂਜਾ ਪਾਠ ਕਰਦੇ ਹਨ ਅਤੇ ਇਸ ਤਰ੍ਹਾਂ ਮੈਂ ਇਸਲਾਮ ਨੂੰ ਮੰਨਣ ਵਾਲਾ ਹਾਂ ਸਾਡੇ ਵਿੱਚ ਪੰਜ ਨ ਨਮਾਜ ਹੁੰਦੀ ਹੈ ਸਵੇਰੇ ਅਤੇ ਦੁਪਹਿਰ 'ਚ ਉਸ ਤੋਂ ਬਾਅਦ ਇੱਕ ਪੰਜ ਵਜੇ ਫਿਰ ਸੱਤ ਵਜੇ ਫਿਰ ਇੱਕ ਨੌ ਵਜੇ ਅਤੇ ਇਹਨਾਂ ਸਾਰਿਆਂ ਨਮਾਜ਼ਾਂ ਦਾ ਨਾਮ ਵੀ ਹੈ ਫਜਰ ਅਸਰ ਜੋਹਰ ਮਗਰਿਬ ਅਤੇ ਇਸਾ ਇਹ ਪੰਜ ਨਮਾਜ਼ ਦੇ ਨਾਮ ਹਨ ਅਤੇ ਇਹ ਸਾਰੇ ਨਮਾਜ਼ ਬਹੁਤ ਜ਼ਰੂਰੀ ਹਨ ਅਤੇ ਸ਼ੁੱਕਰਵਾਰ ਨੂੰ ਇ ਜੁੰਮਾਂ ਦਾ ਨਮਾਜ਼ ਵੀ ਅਦਾ ਕੀਤਾ ਜਾਂਦਾ ਹੈ ਜੋ ਕਿ ਬਹੁਤ ਜ਼ਰੂਰੀ ਹੁੰਦਾ ਹੈ ਇਸ ਨੂੰ ਈਦ ਦੇ ਬਰਾਬਰ ਮੰਨਿਆਂ ਗਿਆ ਹੈ ਇਹ ਸਾਡੇ ਵਿੱਚ ਬਹੁਤ ਜ਼ਰੂਰੀ ਹੁੰਦਾ ਹੈ